ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਹਾ ਤੁਹਾਨੂੰ ਪਤਾ ਸਾਡੇ ਪੰਜਾਬ 'ਚ ਕਿਹੜੀ ਕਿਹੜੀ ਖੇਡਾਂ ਖੇਡੀਆਂ ਜਾਂਦੀਆਂ ਹਾਂਜੀ ਓਕੇ ਵੈਰੀ ਗੁੱਡ ਅੱਜ ਤੁਸੀਂ ਕਿਹੜੀ ਗੇਮ ਖੇਡਣਾ ਚਾਹੁੰਦੇ ਹੋ ਬੈਡਮਿੰਟਨ ਠੀਕ ਹੈ ਚਿੜੀ ਏ ਚਿੜੀ ਇੱਥੇ ਪਈ ਤੁਸੀਂ ਬੈਡਮਿੰਟਨ ਲੈ ਆਓ ਗਰਾਊਂਡ ਵਿੱਚ ਪੰਜ ਵਜੇ ਆ ਜਾਇਓ ਓ ਓਕੇ ਬੇਟਾ ਥੈਂਕ ਯੂ